ਜਦੋਂ ਮੈਂ ਪੱਚੀ ਛੱਬੀ ਸਾਲ ਦਾ ਸੀਗਾ ਤਾਂ ਮੇਰੇ ਮਨ 'ਚ ਆਇਆ ਵੀ ਕੋਈ ਬਾਈਕ ਲਈ ਜਾਵੇ ਫਿਰ ਇੱਕ ਮੇਰਾ ਦੋਸਤ ਸੀ ਉਹਦੇ ਕੋਲ ਪਹਿਲਾਂ ਚੇਤਕ ਸਕੂਟਰ ਹੁੰਦਾ ਸੀ ਉਹ ਕਹਿੰਦਾ ਬਈ ਚੇਤਕ ਲੈ ਜੇ ਲੈਣਾ ਹੈ ਫਿਰ ਮੈਂ ਜੀ ਏਜੰਸੀ ਗਿਆ ਖੰਨੇ ਉੱਥੋਂ ਚੇਤਕ ਸਕੂਟਰ ਲਿਆ ਅ ਤੁਹਾਨੂੰ ਕੀ ਉਹਦਾ ਤਜਰਬਾ ਦੱਸਾ ਚੇਤਕ ਦੇ ਮੈਨੇ ਇੰਨੇ ਨਜ਼ਾਰੇ ਆਏ ਮੈਂ ਮੇਰੇ ਕੋਲ ਕੰਬਾਈਨਾਂ ਦਾ ਕੰਮ ਸੀਗਾ ਕਦੇ ਦੇਖਣ ਜਾਣਾ ਕਦੇ ਗੁਰਦਾਸਪੁਰ ਲੈ ਕੇ ਕੱਥੂ ਨੰਗਲ ਲੈ ਕੇ ਕਦੇ ਅੰਮ੍ਰਿਤਸਰ ਕਦੇ ਫਿਰੋਜ਼ਪੁਰ ਤਰਨ ਤਾਰਨ ਉਦੋਂ ਮੈਂ ਪੇਲਿਆ ਪੂਰਾ ਅਤੇ ਕਦੇ ਉਹਨੇ ਪਰੇਸ਼ਾਨੀ ਨਹੀਂ ਦਿੱਤੀ ਬਹੁਤ ਵਧੀਆ ਚੱਲਦਾ ਰਿਹਾ ਇੱਕ ਅਤੇ ਦੂਜੀ ਗੱਲ ਇਹ ਕਿ ਕੋਈ ਟਾਇਰ ਪੈਂਚਰ ਦਾ ਡਰ ਨਹੀਂ ਤੀ ਹੁੰਦਾ ਜੇ ਹੋ ਵੀ ਗਿਆ ਤਾਂ ਉਹਦੀ ਸਟਿੱਪਣੀ ਉਤਾਰੋ ਲਾ ਲੋ ਅੱਗੇ ਨਾ ਅੱਗੇ ਕਿਤੇ ਨਾ ਕਿਤੇ ਨਾ ਆਪਣਾ ਪੈਂਚਰ ਲਵਾ ਲਉ ਬਹੁਤ ਵਧੀਆ ਟਾਈਮ ਟੂ ਟਾਈਮ ਸਰਵਿਸ ਕਰਾਉਂਦਾ ਕਦੇ ਧੋਖਾ ਨਹੀਂ ਦਿੱਤਾ ਉਹਨੇ ਮੈਨੂੰ ਮੈਨੇ ਉਹ ਲੱਗਭਗ ਅਠਾਰਾਂ ਉੱਨੀ ਸਾਲ ਰੱਖਿਆ ਜੀ ਅਤੇ ਬਹੁਤ ਵਧੀਆ ਉਹ ਨੇ ਸਰਵਿਸ ਦਿੱਤੀ ਮੈਂ ਆਪਣੇ ਮਿੱਤਰਾਂ ਨੂੰ ਮੇਰੇ ਮਿੱਤਰ ਲੈਣ ਨੂੰ ਫਿਰਦੇ ਹੈ ਮੈਂ ਉਹਨੂੰ ਵੀ ਇਹ ਹੀ ਕਿਹਾ ਵੀ ਭਾਈ ਚੇਤਕ ਏ ਲਿਓ ਜੇ ਲੈਣਾ ਸਕੂਟਰ ਮੋਟਰਸਾਈਕਲ ਕੋਈ ਆਪਣੇ ਮਿੱਤਰਾਂ ਨੂੰ ਵੀ ਦੋਸਤਾਂ ਨੂੰ ਵੀ ਮੈਂ ਇਹੀ ਰਿਕਮੈਂਡ ਕਰੂੰਗਾ ਵੀ ਚੇਤਕ ਹੀ ਲਿਆ ਜਾਵੇ ਵਧੀਆ ਚੱਲਦਾ ਉਹ ਠੀਕ ਠਾਕ ਓਕੇ